ਪੰਜਾਬ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਮੀਡੀਆ ਸਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੰਦਾ ਹੈ ਮੀਡੀਆ ਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ ਫਾਇਦੇ ਇਹ ਹਨ ਕਿ ਉਹ ਸਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਦਿੰਦਾ ਹੈ ਕਿੱਥੇ ਕੀ ਚੱਲ ਰਿਹਾ ਹੈ ਕਿੱਥੇ ਕਿੰਨਾਂ ਨੁਕਸਾਨ ਹੋ ਰਿਹਾ ਹੈ ਕਿੰਨਾ ਫਾਇਦਾ ਹੋ ਰਿਹਾ ਹੈ ਅਤੇ ਨੁਕਸਾਨ ਇਹ ਹੈ ਕਿ ਉਹ ਬਹੁਤ ਵਾਰੀ ਝੂਠੀਆਂ ਖਬਰਾਂ ਵੀ ਫੈਲਾਉਂਦੇ ਹਨ ਜੋ ਕਿ ਚੰਗੀ ਗੱਲ ਨਹੀਂ ਹੈ